ਹਾਂ ਅਸੀਂ ਮੰਨਦੇ ਹਾਂ ਕਿ ਤਕਨਾਲੋਜੀ ਬਾਰੇ ਲੀਅਰਿੰਗ ਕਰਨਾ ਸਭ ਲਈ ਅਧਿਐਨ ਕਰਨ ਲਈ ਇੱਕ ਬੁਨਿਆਦੀ ਵਿਸ਼ਾ ਹੋਣਾ ਚਾਹੀਦਾ ਹੈ ਜਿਵੇਂ ਕਿ ਮੇਰਾ ਮੰਨਣਾ ਇਹ ਹੈ ਕਿ ਲੀਅਰਿੰਗ ਤੋਂ ਬਿਨਾਂ ਅਧਿਐਨ ਨਹੀਂ ਹੋ ਸਕਦਾ ਬੁਨਿਆਦੀ ਵਿਸ਼ਾ ਤਕਨਾਲੋਜੀ ਦੇ ਹਿਸਾਬ ਨਾਲ ਹੋਣਾ ਜ਼ਰੂਰੀ ਹੈ ਜਿਸ ਨਾਲ ਸਾਨੂੰ ਸਮੇਂ ਦੇ ਹਿਸਾਬ ਨਾਲ ਬਹੁਤ ਚੀਜ਼ਾਂ ਦਾ ਅਧਿਐਨ ਹੁੰਦਾ ਹੈ ਜਿਵੇਂ ਕਿ ਦੇਖਿਆ ਜਾਵੇ ਅੱਜ ਸਾਇੰਸ ਨੇ ਨਵੀਂ ਤ ਤਕਨਾਲੋਜੀ ਨਾਲ ਬਹੁਤ ਤਰੱਕੀ ਕਰ ਲਈ ਹੈ ਜਿਸ ਕਾਰਨ ਸਾਨੂੰ ਅਧਿਐਨ ਹੋਣਾ ਜ਼ਰੂਰੀ ਹੈ ਤਾਂ ਮੇਰਾ ਮੰਨਣਾ ਇਹ ਹੈ ਕਿ ਸਾਇੰਸ ਵਰਗਾ ਕੋਈ ਬੁਨਿਆਦੀ ਵਿਸ਼ਾ ਹੋਣਾ ਜ਼ਰੂਰੀ ਹੈ